ਹਾਂਜੀ ਯੋਗ ਅਭਿਆਸ ਕਰਨ ਤੋਂ ਸਾਨੂੰ ਬਹੁਤ ਲਾਭ ਮਿਲਦੇ ਨੇ ਮੰਨ ਲਓ ਜਿਵੇਂ ਆਪਾਂ ਯੋਗਾ ਕਰਦੇ ਹਾਂ ਤਾਂ ਇਸ ਨਾਲ ਆਪਣਾ ਜਿਹੜਾ ਸਰੀਰ ਆ ਉਹ ਫਿਟ ਰਹਿੰਦਾ ਆਪਣੇ ਜਿਹੜੇ ਸਰੀਰ ਦੀ ਬਣਾਵਟ ਆ ਉਹਦੇ ਵਿੱਚ ਕਾਫੀ ਚੇਂਜ ਆ ਜਾਂਦੀ ਹੈ ਮੰਨ ਲਓ ਜਿਵੇਂ ਹੁਣ ਆਪਾਂ ਯੋਗਾ ਕਰਦੇ ਹਾਂ ਤਾਂ ਇਸਨੂੰ ਆਪਣੇ ਜਿਹੜੇ ਸਰੀਰ ਦੀਆਂ ਝੁਰੜੀਆਂ ਨੇ ਉਹ ਖਤਮ ਹੁੰਦੀਆਂ ਆਪਣੇ ਸਰੀਰ 'ਤੇ ਗਲੋ ਆਉਂਦਾ ਜਿਸ ਨਾਲ ਆਪਣਾ ਸ ਚਿਹਰਾ ਸਾਫ ਸੁਥਰਾ ਅਤੇ ਸੁੰਦਰ ਲੱਗਦਾ ਇਕ ਹੋਰ ਸਭ ਤੋਂ ਬੈਨੀਫਿਟ ਯੋਗ ਇਹਦਾ ਇਹ ਹੁੰਦਾ ਕਿ ਇਹਦੇ ਨਾਲ ਆਪਣਾ ਜਿਹੜਾ ਮੋਟਾਪਾ ਉਹ ਘੱਟ ਹੁੰਦਾ ਜਿਹੜਾ ਮੰਨ ਲਓ ਸੱਤਰ ਪਝੱਤਰ ਕਿਲੋ ਦਾ ਵਜਨ ਵਾਲਾ ਇਨਸਾਨ ਆ ਉਹਦਾ ਵੇਟ ਬਹੁਤ ਲੂਜ਼ ਹੋ ਜਾਂਦਾ ਇਹ ਇਹਦੇ ਨਾਲ ਆਪਣਾ ਜਿਹੜਾ ਸ ਖੂਨ ਦਾ ਸੰਚਾਰ ਆ ਉਹ ਸਹੀ ਚਲਦਾ ਗਾ ਉਹਦੇ ਨਾਲ ਆਪਣਾ ਸਰਕਲ ਸਹੀ ਚਲਦਾ ਗਾ ਆਪਣਾ ਜਿਹੜਾ ਸਭ ਤੋਂ ਮੇਨ ਹੁੰਦਾ ਆਪਣਾ ਹਾਰਟ ਜੇ ਆਪਣਾ ਹਾਰਟ ਚਲੇਗਾ ਤਾਂ ਹੀ ਆਪਣਾ ਸਰੀਰ ਚੱਲੂ ਇਸ ਨਾਲ ਆਪਣਾ ਹਾਰਟ ਵੀ ਚੌਵੀ ਘੰਟੇ ਸਹੀ ਕੰਮ ਕਰਦਾ ਗਾ ਇਕ ਸਭ ਤੋਂ ਮੇਨ ਗੱਲ ਇਸ ਨਾਲ ਆਪਣੀ ਜਿਹੜੀ ਨਿਗ੍ਹਾ ਨਾ ਉਹ ਸਹੀ ਰਹਿੰਦੀ ਆ ਆਪਣੇ ਅੱਖਾਂ ਦੀ ਰੌਸ਼ਨੀ ਵੱਧਦੀ ਆ ਅੱਖਾਂ ਦੀ ਰੌਸ਼ਨੀ ਵੱਧਣ ਨਾਲ ਆਪਾਂ ਨੇ ਅੱਖਾਂ ਦੀ ਰੌਸ਼ਨੀ ਵੱਧਣ ਨਾਲ ਆਪਾਂ ਨੂੰ ਸਾਫ ਕਲੀਅਰ ਨੈਚੁਰਲ ਦਿਖਦਾ ਇਸ ਨਾਲ ਯੋਗਾ ਕਰਨ ਨਾਲ ਆਪਣਾ ਜਿਹੜਾ ਆਕਸੀਜਨ ਲੈਵਲ ਆ ਉਹ ਸਹੀ ਰਹਿੰਦਾ ਇਹਦਾ ਨਾਲ ਕੋਈ ਘਟਦਾ ਵਧਦਾ ਜਿਵੇਂ ਹੁਣ ਯੋਗਾ ਕਰਾਂਗੇ ਤਾਂ ਆਪਾਂ ਨੂੰ ਕਾਫੀ ਬੈਨੀਫਿਟਸ ਹੋ ਜਾਂਦੇ ਨੇ ਜੇ ਆਪਾਂ ਯੋਗਾ ਹੀ ਨਹੀਂ ਕਰਾਂਗੇ ਤਾਂ ਆਪਣਾ ਸਰੀਰ ਬਿਮਾਰੀਆਂ ਨਾਲ ਘਿਰ ਜਾਂਦਾ ਜਿਸ ਕਰਕੇ ਆਪਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਡਾਕਟਰ ਤੋਂ ਜਾਂਦੇ ਇੰਨੀਆਂ ਦਵਾਈਆਂ ਦਿੰਦੇ ਨੇ ਇਸ ਲਈ ਦਵਾਈਆਂ ਤੋਂ ਪਰਹੇਜ਼ ਨਾਲ ਤਾਂ ਆਪਾਂ ਨੂੰ ਯੋਗਾ ਹੀ ਵਧੀਆ ਯੋਗ ਕਰਾਂਗੇ ਆਪਾਂ ਤੰਦਰੁਸਤ ਰਵਾਂਗੇ ਫਿਟ ਰਹਾਂਗੇ ਸਰੀਰ ਆਪਣਾ ਵਧੀਆ ਰਹੂਗਾ ਅਤੇ ਆਪਣੇ ਖੂਨ ਦਾ ਲੈਵਲ ਹੈ ਜੋ ਹੋਰ ਸ ਸਹੀ ਰਹੇਗਾ ਇਸ ਨਾਲ ਆਪਣੀ ਪਾਚਨ ਕਿਰਿਆ ਵੀ ਸਹੀ ਰਹਿੰਦੀ ਆ ਆਪਣਾ ਪੇਟ ਸਾਫ ਹੋ ਜਾਂਦਾ ਆਪਣੇ ਫੇਫੜੇ ਸਹੀ ਰਹਿੰਦੇ ਆ ਆਪਣੇ ਸਾਹ ਦੀ ਜਿਹੜੀ ਪ੍ਰਕਿਰਿਆ ਉਹ ਬਿਲਕੁਲ ਸਹੀ ਚਲਦੀ ਆ ਆਪਾਂ ਨੂੰ ਕੋਈ ਸਾਹ ਲੈਣ 'ਚ ਦਿੱਕਤ ਨਹੀਂ ਆਉਂਦੀ ਸਭ ਤੋਂ ਐਂ ਆਪਣਾ ਜਿਹੜਾ ਮਾਇੰਡ ਹੈ ਨਾ ਉਹ ਬਿਲਕੁਲ ਫਰੈਸ਼ ਰਹਿੰਦਾ ਉਹ ਸਹੀ ਢੰਗ ਨਾਲ ਕੰਮ ਕਰਦਾ ਹੈਗਾ ਮਾਇੰਡ ਆਪਣਾ ਬਿਲਕੁਲ ਫਰੈਸ਼ ਹੋ ਜਾਂਦਾ ਗਾ